ਪਿਛਲੇ ਕਈ ਦਿਨ ਪਹਿਲਾਂ ਮੈਂ ਔਨਲਾਈਨ ਸ਼ੋਪਿੰਗ ਵੈਬਸਾਈਟ ਐਮਾਜ਼ੋਨ ਤੋਂ ਹੈਡਫੋਨ ਜੋ ਕਿ ਸੋਨੀ ਕੰਪਨੀ ਦੇ ਸੀ ਅਤੇ ਉਹ ਵਾਇਰਲੈਸ ਸੀ ਅਤੇ ਬਲੂਟੂਥ ਹੈਡਫੋਨ ਸੀ ਅਤੇ ਫੀਡਬੈਕ ਉੱਥੇ ਬਹੁਤ ਵਧੀਆ ਸਟਾਰ ਕੀਤੇ ਹੋਏ ਸੀ ਅਤੇ ਮੈਂ ਚੰਗੀ ਤਰ੍ਹਾਂ ਦੇਖ ਕੇ ਉਹ ਬਾਏ ਕਰ ਲਏ ਉੱਥੇ ਉਹਨਾਂ ਦੀ ਡਿਲੀਵਰੀ ਡੇਟ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਸੀ ਪਰ ਫਿਰ ਵੀ ਉਹ ਬਹੁਤ ਲੇਟ ਆਏ ਛੇ ਸੱਤ ਦਿਨ ਬਾਅਦ ਆਏ ਫਿਰ ਮੈਂ ਉਹਨਾਂ ਦੀ ਅਨਬੋਕਸਿੰਗ ਕੀਤੀ ਮੈਂ ਬਹੁਤ ਐਕਸਾਈਟਿਡ ਸੀ ਅਤੇ ਮੈਂ ਉੱਥੇ ਕਲਰ ਬਲੈਕ ਕਲਰ ਦੇ ਔਡਰ ਕੀਤੇ ਸੀ ਪਰ ਉਹ ਪਿੰਕ ਕਲਰ ਦੇ ਆਏ ਜਦੋਂ ਮੈਂ ਉਹਨਾਂ ਦੀ ਅਨਬਾਕਸਿੰਗ ਕੀਤੀ ਤਾਂ ਮੈਂ ਦੇਖਿਆ ਉਹ ਚੰਗੀ ਤਰ੍ਹਾਂ ਕਨੈਕਟ ਨਹੀਂ ਹੋ ਰਹੇ ਸੀ ਵਿੱਚ ਵਿੱਚ ਕੱਟ ਕੱਟ ਕੇ ਆਵਾਜ਼ ਆ ਰਹੀ ਸੀ ਮੈਂ ਉਹਨਾਂ ਦੀ ਬੇਸ ਉਹਨਾਂ ਦੀ ਬੇਸ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਜਿਸ ਕਾਰਨ ਮੈਂ ਬਹੁਤ ਦੁਖੀ ਹੋਇਆ ਅਤੇ ਉਹਨਾਂ ਦੀ ਰਿਟਰਨ ਡੇਟ ਵੀ ਲੰਘ ਗਈ ਸੀ ਨਾ ਹੀ ਉਹ ਹੁਣ ਵਾਪਸ ਹੋਣੇ ਸੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਔਨਲਾਈਨ ਸ਼ੋਪਿੰਗ ਨਾਲੋਂ ਸਾਨੂੰ ਸਾਰਿਆਂ ਨੂੰ ਔਫਲਾਈਨ ਸ਼ੋਪਿੰਗ ਕਰਨੀ ਚਾਹੀਦੀ ਹੈ ਜਿਸ ਵਿੱਚ ਸਾਨੂੰ ਚੀਜ਼ ਦੇਖ ਕੇ ਲੈ ਸਕਦੇ ਹਾਂ ਅਸੀਂ ਇਸ ਵਿੱਚ ਮੇਰੇ ਪੈਸੇ ਅਤੇ ਸਮਾਂ ਦੋਨੋਂ ਖਰਾਬ ਹੋਏ